ਹਾਂਜੀ ਸਾਡੇ ਘਰ ਦੇ ਕੋਲ ਹੀ ਇੱਕ ਤਰਨ ਤਾਰਨ ਰੋਡ ਹੈ ਉੱਥੇ ਜਲ ਘਰ ਬਹੁਤ ਹੀ ਵਧੀਆ ਬਣਿਆ ਹੋਇਆ ਉਹਦੀ ਸਾਂਭ ਸੰਭਾਲ ਵੀ ਬਹੁਤ ਚੰਗੀ ਹੈਗੀ ਹੈ ਉਹਦੇ ਵਿੱਚ ਫਿਸ਼ਿੰਗ ਤਾਂ ਨਹੀਂ ਹੋ ਸਕਦੀ ਪਰ ਬੋਟਿੰਗ ਵੀ ਆਪਾਂ ਕਰ ਸਕਦੇ ਹਾਂ ਆਲਾ ਦੁਆਲਾ ਏਰੀਆ ਵੀ ਬਹੁਤ ਵਧੀਆ ਹੈ ਅਤੇ ਉੱਥੋਂ ਦਾ ਪਾਣੀ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਵਾ ਉੱਥੋਂ ਦੀ ਸਾਫ਼ ਸਫ਼ਾਈ ਆਲੇ ਦੁਆਲੇ ਦਾ ਏਰੀਆ ਵੀ ਬਹੁਤ ਸ਼ੁੱਧ ਹੈਗਾ ਵਾ ਕੋਈ ਉਹ 'ਚ ਪਲਿਊਸ਼ਨ ਵਗੈਰਾ ਬਿਲਕੁਲ ਨਹੀਂ ਹੈਗਾ ਅਤੇ ਤੁਸੀਂ ਤੁਸੀਂ ਜਾਣਦੇ ਹੋ ਕਿ ਮੈਂ ਕਾਫ਼ੀ ਟਾਈਮ ਪਹਿਲਾਂ ਹਾਰਟ ਦੀਆਂ ਸਮੱਸਿਆਵਾਂ ਤੋਂ ਗੁਜਰੀ ਹਾਂ ਜਿਹਦੇ ਵਿੱਚ ਮੈਨੂੰ ਬਹੁਤ ਹੀ ਔਖਾ ਸਮਾਂ ਸਮੇਂ ਵਿੱਚੋਂ ਲੰਘਣਾ ਪਿਆ ਬਹੁਤ ਜ਼ਿਆਦਾ ਮੁਸ਼ਕਿਲ ਵਿੱਚ ਰਹਿਣਾ ਪਿਆ ਉੱਥੇ ਘਰ ਦੇ ਕੋਲ ਸਾਡੇ ਜਿੱਥੇ ਮੈਂ ਰਹਿ ਰਹੀ ਸੀ ਪਾਣੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਾਣੀ ਨਾਲ ਸਭ ਕੁਛ ਭਰ ਗਿਆ ਮੈਨੂੰ ਉਹ ਜਗਾ ਛੱਡ ਕੇ ਕਿਤੇ ਦੂਰ ਵੀ ਜਾਣਾ ਪਿਆ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਸਾਡੀਆਂ ਹੋਰ ਸਰਕਾਰਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਸਾਡਾ ਖਾਣ ਪਾਣ ਦਾ ਸਾਰਾ ਸਮਾਨ ਸਾਨੂੰ ਦੇਣ ਆਉਂਦੇ ਰਹੇ ਅਤੇ ਇਸੇ ਤਰ੍ਹਾਂ ਹੋਰ ਵੀ ਕਈ ਇਲਾਕਿਆਂ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਦੇ ਘਰ ਤਬਾਅ ਹੋ ਗਏ ਇੰਨੇ ਇੰਨੇ ਵੱਡੇ ਹੜ੍ਹ ਆਉਣ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਕਰਕੇ ਉਹਨਾਂ ਨੂੰ ਬਹੁਤ ਉਹਨਾਂ ਦੇ ਖਾਣ ਪਾਣ ਰਹਿਣ ਸਹਿਣ ਸਭ ਕੁਛ ਉਹਨਾਂ ਦਾ ਬਦਲ ਗਿਆ